ਹਾਂ ਮੈਂ ਰਿਲੇਅ ਦੋੜ ਚਲਾਈ ਹੈ ਤੇ ਮੇਰਾ ਅਨੁਭਵ ਬਹੁਤ ਵਧੀਆ ਰਿਹਾ ਹੈ ਮੈਂ ਰਿਲੇਅ ਦੋੜ ਕਾਰਨ ਇੰਸਟਾਗਰਾਮ ਤੇ ਪਿੰਕਾ ਚਾਰਜ ਨੂੰ ਫੋਲੋ ਕਰ ਰਿਹਾ ਹੈ ਉਹ ਬਹੁਤ ਵਧੀਆ ਰਿਲੇਅ ਦੌੜ ਕਰਾ ਰਿਹਾ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਜਿੰਦਗੀ ਵਿੱਚ ਉਤਸਾਹ ਭਰਿਆ ਤੇ ਮੈਂ ਰਿਲੇਅ ਦੌੜ ਦਾ ਇੱਕ ਹਿੱਸਾ ਬਣਿਆ ਇਹ ਇੱਕ ਅਜਿਹੀ ਹੈ ਇਹਦੇ ਵਿੱਚ ਕੀਮਤ ਤੁਹਾਨੂੰ ਭਾਵੇਂ ਨਾ ਵੀ ਮਿਲੇ ਤੁਸੀਂ ਰਿਲੇਅ ਦੌੜ ਦੇ ਨਾਲ ਨਾਲ ਆਪਣੇ ਸਰੀਰ ਨੂੰ ਵੀ ਫਿੱਟ ਰੱਖਿਆ ਸੀ ਸਾਡੇ ਕੋਲ ਸਲਾਹਤੀ ਲਈ ਤਾਂ ਮੈਂ ਆਨਲਾਈਨ ਹੀ ਟਰੇਨ ਰੱਖੇ ਹਨ ਮੇਰੇ ਨਾਲ ਇੱਕ ਸਲਾਹਕਾਰ ਪਿੰਕਾ ਜਰਜਰ ਹੋਣੀ ਬਹੁਤ ਵਧੀਆ ਉਹਨਾਂ ਡੀਲ ਕਰਦੇ ਹਨ ਤੇ ਮੈਨੂੰ ਸਮਝਾਉਂਦੇ ਹਨ ਤੇ ਹਰੇਕ ਨਾਲ ਹੀ ਪਿਆਰ ਨਾਲ ਵਰਤਾਵਾ ਕਰਦੇ ਹਨ ਮੈਨੂੰ ਜਦੋਂ ਵੀ ਕੋਈ ਲੋੜ ਪੈਂਦੀ ਹੈ ਮੈਂ ਉਹਨਾਂ ਨੂੰ ਚੱਕ ਕੇ ਫੋਨ ਲਾ ਲੈਂਦਾ ਹਾਂ ਜਾਂ ਉਹਨਾਂ ਨੂੰ ਮਿਲ ਲੈਂਦਾ ਹਾਂ